ਮੇਰੇ ਖੇਤਰ ਵਿੱਚ ਮੋਬਾਇਲ ਫੋਨ ਅਤੇ ਟੈਲੀਫੋਨ ਅੱਜ ਕੱਲ੍ਹ ਸਭ ਲੋਕਾਂ ਕੋਲ ਹੀ ਹਨ ਅਤੇ ਇਸ ਵਿੱਚ ਅੱਜ ਕੱਲ੍ਹ ਰੈਡਮੀ ਦਾ ਬ੍ਰੈਂਡ ਬਹੁਤ ਹੀ ਪ੍ਰਚੱਲਿਤ ਹੈ ਕਿਉਂਕਿ ਉਹ ਸਸਤੇ ਰੇਟਾਂ ਵਿੱਚ ਹੀ ਕਾਫੀ ਵਧੀਆ ਅਤੇ ਨਵੇਂ ਨਵੇਂ ਫੀਚਰ ਦਿੰਦਾ ਹੈ ਮੇਰੇ ਕੋਲ ਵੀ ਪਹਿਲਾਂ ਰੈਡਮੀ ਦਾ ਹੀ ਫੋਨ ਹੁੰਦਾ ਸੀ ਅਤੇ ਉਹ ਕਾਫੀ ਸਾਲ ਉਸ ਨੇ ਮੇਰਾ ਸਾਥ ਦਿੱਤਾ ਹੈ ਹੁਣ ਇਸ ਟੈਮ ਮੇਰੇ ਕੋਲ ਐਪਲ ਦਾ ਫੋਨ ਹੈ ਜੋ ਕਿ ਇੱਕ ਅੰਤਰਰਾਸ਼ਟਰੀ ਬ੍ਰੈਂਡ ਹੈ ਇਹ ਕਾਫੀ ਮਹਿੰਗਾ ਸੀ ਪਰ ਇਸ ਤੋਂ ਮੈਂ ਕਾਫੀ ਸੰਤੁਸ਼ਟ ਹਾਂ ਮੇਰਾ ਸ਼ੌਕ ਫੋਟੋਗ੍ਰਾਫੀ ਅਤੇ ਫੋਟੋਆਂ ਖਿੱਚਣ ਵਿੱਚ ਹੈ ਜਿਸ ਵਿੱਚ ਐਪਲ ਦਾ ਫੋਨ ਸਭ ਤੋਂ ਉੱਚ ਪੱਧਰ ਦਾ ਹੈ ਇਸ ਵਿੱਚ ਫੋਟੋਆਂ ਕਾਫੀ ਸਾਫ ਅਤੇ ਸੋਹਣੀਆਂ ਆਉਂਦੀਆਂ ਹਨ ਮੈਂ ਵੀ ਅਗਰ ਕੋਈ ਫੋਨ ਦੇਖਦਾ ਹਾਂ ਤਾਂ ਉਸ ਵਿੱਚ ਆਹੀ ਵਿਸ਼ੇਸ਼ਤਾ ਲੱਭਦਾ ਹਾਂ ਕਿ ਉਸਦਾ ਕੈਮਰਾ ਅੱਛਾ ਹੋਵੇ ਅਤੇ ਕੈਮਰਾ ਅੱਛਾ ਹੋਣ ਦੇ ਨਾਲ ਨਾਲ ਉਹ ਚੰਗਾ ਚੱਲਣਾ ਚਾਹੀਦਾ ਹੈ ਹੈਂਗ ਨਹੀਂ ਹੋਣਾ ਚਾਹੀਦਾ ਉਸ ਵਿੱਚ ਵਧੀਆ ਪ੍ਰੋਸੈਸਰ ਹੋਣਾ ਚਾਹੀਦਾ ਹੈ ਅਤੇ ਉਸਦੀ ਸਕਰੀਨ ਵੀ ਸਾਫ ਅਤੇ ਤਕੜੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਇੰਨੀ ਆਸਾਨੀ ਨਾਲ ਟੁੱਟੇ ਨਹੀਂ ਅੱਜ ਕੱਲ੍ਹ ਇਹ ਫੀਚਰ ਸਸਤੇ ਤੋਂ ਸਸਤੇ ਅਤੇ ਮਹਿੰਗੇ ਤੋਂ ਮਹਿੰਗੇ ਫੋਨਾਂ ਵਿੱਚ ਵੀ ਆਉਂਦੇ ਹਨ ਪਰ ਫੇਰ ਵੀ ਕੁਝ ਲੋਕ ਸਿਰਫ ਪੈਸੇ ਦਾ ਦਿਖਾਵਾ ਕਰਨ ਵਾਸਤੇ ਮਹਿੰਗੇ ਫੋਨ ਲੈਂਦੇ ਹਨ